ਨੌ ਜਨਵਰੀ ਉੱਨੀ ਸੌ ਪੰਤਾਲੀ ਸੋਲਾਂ ਮਾਰਚ ਉੱਨੀ ਸੌ ਪਚੱਤਰ ਤੇਈ ਜੂਨ ਉੱਨੀ ਸੌ ਪਚਾਸੀ ਅਠਾਈ ਜੁਲਾਈ ਉੱਨੀ ਸੌ ਨੜਿਨਵੇਂ ਤੀਹ ਸਤੰਬਰ ਦੋ ਹਜ਼ਾਰ